ਸਤਿ ਸ਼੍ਰੀ ਅਕਾਲ ਸਰ ਬਸ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਹਾਂਜੀ ਹਾਂਜੀ ਸਰ ਬਹੁਤ ਵਧੀਆ ਜੀ ਇੱਥੇ ਆ ਕੇ ਵਧੀਆ ਹੈਗਾ ਸਾਰਾ ਸਿਸਟਮ ਅਤੇ ਸਿਟੀ ਵੀ ਨੇੜੇ ਆ ਰੂਰਲ ਏਰੀਆ ਵੀ ਨੇੜੇ ਹੈ ਸਾਰੀਆਂ ਚੀਜ਼ਾਂ ਨੇੜੇ ਨੇ ਜੀ ਬਹੁਤ ਵਧੀਆ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਬਸ ਪਲੈਨਿੰਗ ਇਹੀ ਹੈ ਕਿ ਵੀ ਸੋਚ ਰਹੇ ਸੀ ਵੀ ਕਿਤੇ ਆਸ ਪਾਸ ਸਟੇਸ਼ਨ ਹੋਵੇ ਤਾਂ ਘੁੰਮ ਲਿਆ ਜਾਵੇ ਵਧੀਆ ਜਗ੍ਹਾ ਹੈਗੀ ਹੈ ਕਿ ਹੈ ਇੱਥੇ ਆਪਣੇ ਆਸ ਪਾਸ ਕੋਈ ਇੱਥੇ ਹਿਲ ਸਟੇਸ਼ਨ ਜਿੱਥੇ ਜਾ ਸਕਦੇ ਹਾਂ ਅਸੀਂ ਸਾਰਾ ਪਰਿਵਾਰ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਸਰ ਠੀਕ ਹੈ ਅੱਛਾ ਜੀ ਅੱਛਾ ਜੀ ਹਾਂਜੀ ਅੱਛਾ ਇਹ ਨੇੜੇ ਹੈ ਲੁਧਿਆਣੇ ਦੇ ਇਹ ਤਾਂ ਫਿਰ ਕੋਈ ਵੀ ਜ਼ਿਆਦਾ ਨਹੀਂ ਹੈ ਤਾਂ ਫਿਰ ਬਿਲਕੁਲ ਠੀਕ ਹੈ ਰਸਤਾ ਹੈ ਨਾ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਫਿਰ ਤਾਂ ਬਹੁਤ ਵਧੀਆ ਫਿਰ ਤਾਂ ਮਾਤਾ ਰਾਣੀ ਦੇ ਦਰਸ਼ਨ ਵੀ ਹੋ ਜਾਂਦੇ ਹੋ ਜਾਣਗੇ ਬਹੁਤ ਵਧੀਆ ਗੱਲ ਹੈ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਚਲੋ ਠੀਕ ਹੈ ਸਰ ਕੋਈ ਗੱਲ ਨਹੀਂ ਫਿਰ ਜ਼ਰੂਰ ਅਸੀਂ ਵਿਜਿਟ ਕਰਾਂਗੇ ਅੱਛੀਆਂ ਪਲੇਸਿਸ ਨੇ ਇਹਦੇ ਵਿੱਚ ਕੀ ਦੇਖਣ ਵਾਲਾ ਹੈਗਾ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਸੁਣਿਆ ਜੀ ਹੈਰੀਟੇਜ ਮਾਰਕੀਟ ਹੈਗੀ ਹੈ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਹਾਂਜੀ ਹਾਂਜੀ ਹਾਂ ਹਾਂ ਹਾਂ ਹਮ ਹਮ ਹਮ ਠੀਕ ਹੈ ਠੀਕ ਹੈ ਸਰ ਚਲੋ ਵਧੀਆ ਗੱਲ ਹੈ ਜੀ ਜਾ ਕੇ ਆਵਾਂਗੇ ਜ਼ਰੂਰ ਅੱਛੀਆਂ ਪਲੇਸਿਸ ਨੇ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਸਰ ਕੀ ਕਸੋਲੀ ਤੋਂ ਸ਼ਿਮਲਾ ਕਿੰਨੇ ਕਿਲੋਮੀਟਰ ਉੱਪਰ ਇਹ ਕੋਈ ਆਈਡੀਆ ਹੈਗਾ ਤੁਹਾਨੂੰ ਅੱਛਾ ਜੀ ਪੈਂਤੀ ਚਾਲ੍ਹੀ ਕਿਲੋਮੀਟਰ ਹੀ ਹੈ ਜ਼ਿਆਦਾ ਨਹੀਂ ਹੈ ਠੀਕ ਹੈ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਅੱਛਾ ਨਹੀਂ ਚਲੋ ਫਿਰ ਤਾਂ ਬਹੁਤ ਵਧੀਆ ਗੱਲ ਹੈ ਜੀ ਅਤੇ ਉੱਥੇ ਜਾਵਾਂਗੇ ਜ਼ਰੂਰ ਹੈ ਨਾ ਕੋਈ ਗੱਲ ਨਹੀਂ ਫੈਮਲੀ ਆ ਹਾਂ ਅੱਛਾ ਜੀ ਅੱਛਾ ਜੀ ਕੋਈ ਗੱਲ ਨਹੀਂ ਸਰ ਮੈਨੂੰ ਤਾਂ ਜਾਵਾਂਗੇ ਬੰਦਾ ਫਿਰ ਸਾਰੇ ਕਿਤੇ ਘੁੰਮੀ ਜਾਂਦਾ ਬਹੁਤ ਵਧੀਆ ਗੱਲ ਹੈ ਚਲੋ ਕੋਈ ਗੱਲ ਨਹੀਂ ਪਲੈਨਿੰਗ ਬਣਾਉਂਦੇ ਹਾਂ ਤੁਹਾਡੇ ਪਰਿਵਾਰ ਨੂੰ ਵੀ ਚੱਲਾਂਗੇ ਨਾਲ ਲੈ ਕੇ ਕਿਤੇ ਬਣਾਵਾਂਗੇ ਪ੍ਰੋਗਰਾਮ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਸਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਓਕੇ ਜੀ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਓਕੇ ਜੀ